ਹੈਲੋ ਪੰਜਾਬ ਵਿੱਚ ਬਹੁਤ ਹੀ ਪ੍ਰਮੁੱਖ ਵਪਾਰਕ ਸੰਸਥਾਵਾਂ ਹਨ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕੱਪੜੇ ਦੀਆਂ ਮਸ਼ਹੂਰ ਮਿੱਲਾਂ ਉਸੀਆਂ ਮਿਲਸ ਐਸਮਾ ਮਿਲਸ ਹੋਰ ਇੱਥੇ ਜੇ ਸੀ ਟੀ ਫਗਵਾੜਾ ਦੇ ਵਿੱਚ ਮਿੱਲ ਹੈ ਲੁਧਿਆਣੇ ਦੇ ਵਿੱਚ ਬਹੁਤ ਸਾਰੀਆਂ ਕਾਰੋਬਾਰੀ ਸੰਸਥਾਵਾਂ ਦੇ ਵਿੱਚ ਆਇਲ ਮਿੱਲ ਮਸ਼ੀਨਰੀ ਮੈਨੂਫੈਕਚਰਿੰਗ ਐਸੋਸੀਏਸ਼ਨ ਕੇ ਡਬਲਯੂ ਐਸੋਸੀਏਸ਼ਨ ਚੈਂਬਰ ਆਫ ਇੰਡਸਟਰੀਅਲ ਕਮਰਸ਼ੀਅਲ ਅੰਡਰਟੇਕਿੰਗ ਔਰ ਮੰਡੀ ਗੋਬਿੰਦਗੜ੍ਹ ਦੇ ਵਿੱਚ ਬਹੁਤ ਸਾਰੀਆਂ ਫਰਨੈਸ ਮਿੱਲਾਂ ਜੋ ਕਿ ਕੱਚੇ ਲੋਹੇ ਨੂੰ ਬਣਾਉਂਦੀਆਂ ਹਨ ਇਸੇ ਤਰ੍ਹਾਂ ਹੀ ਬਟਾਲਾ ਦੇ ਵਿੱਚ ਬਹੁਤ ਸਾਰੀਆਂ ਪ੍ਰਮੁੱਖ ਲੋਹੇ ਦੀਆਂ ਮਿੱਲਾਂ ਜੋ ਕਿ ਟੋਕਾ ਮਸ਼ੀਨਾਂ ਆਦਿ ਲੋਹੇ ਦੀਆਂ ਬਣਾਉਂਦੀਆਂ ਹਨ ਅੰਮ੍ਰਿਤਸਰ ਦੇ ਵਿੱਚ ਪ੍ਰੈੱਸ ਦੀਆਂ ਮਸ਼ੀਨਾਂ ਬਹੁਤ ਸਾਰੀਆਂ ਹਨ ਵੱਡੀਆਂ ਵੱਡੀਆਂ ਕੰਪਨੀਆਂ ਅਦਾਰੇ ਹਨ ਜੋ ਕਿ ਬਹੁਤ ਸਾਰੀਆਂ ਕਾਰੋਬਾਰੀ ਮਸ਼ੀਨਾਂ ਸੋ ਪੂਰੇ ਹਿੰਦੁਸਤਾਨ ਵਿੱਚ ਸਪਲਾਈ ਕਰਦੀਆਂ ਹਨ ਲੁਧਿਆਣਾ ਦੇ ਵਿੱਚ ਸਾਈਕਲ ਪਾਰਟਸ ਦੀਆਂ ਬਹੁਤ ਸਾਰੀਆਂ ਨੀਲਮ ਸਾਈਕਲਸ ਹੀਰੋ ਸਾਈਕਲਸ ਆਦਿ ਪ੍ਰਮੁੱਖ ਕੰਪਨੀਆਂ ਹਨ ਜੋ ਕਿ ਬਹੁਤ ਵੱਡੇ ਲੈਵਲ 'ਤੇ ਆਪਣੇ ਸਾਈਕਲ ਪਾਰਟਸ ਬਣਾਉਂਦੀਆਂ ਹਨ ਅਤੇ ਸਾਈਕਲ ਬਣਾ ਕੇ ਵੇਚਦੀਆਂ ਹਨ